ਸਕੂਲੀ ਪੜ੍ਹਾਈ ਤੋਂ ਬਾਅਦ ਸਾਰੇ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਨਹੀਂ ਕਰਦੇ ਕਈ ਤਾਂ ਆਪਣੇ ਕਾਰੋਬਾਰ 'ਚ ਚਲੇ ਜਾਂਦੇ ਹਨ ਅਤੇ ਕਈ ਖੇਤਰ ਵਿੱਚ ਨੌਕਰੀ ਲਈ ਚਲੇ ਜਾਂਦੇ ਹਨ